ਸੱਤ ਅਪ੍ਰੈਲ ਉੱਨੀ ਸੌ ਸਤਾਸੀ ਚਾਰ ਮਾਰਚ ਦੋ ਹਜ਼ਾਰ ਸੋਲ੍ਹਾਂ ਪੰਜ ਮਈ ਦੋ ਹਜ਼ਾਰ ਤੇਈ ਇੱਕੀ ਨਵੰਬਰ ਉੱਨੀ ਸੌ ਨੱਬੇ ਪੱਚੀ ਫਰਵਰੀ ਉੱਨੀ ਸੌ ਵੀਹ